ਭੰਗੜਾ ਦੁਨੀਆਂ ਦਾ ਬਹੁਤ ਹੀ ਜੋਸ਼ੀਲਾ ਮੰਨੋਰੰਜਕ ਅਤੇ ਸਿਹਤ ਨੂੰ ਠੀਕ ਰੱਖਣ ਵਾਲਾ ਇੱਕ ਇੱਕ ਕਲਾ ਇਹ ਜ਼ਿਆਦਾਤਰ ਤਾਂ ਖੁਸ਼ੀਆਂ ਦੇ ਮੌਕੇ ਪਾਰਟੀਆਂ ਉਹ ਵੀ ਖੁਸ਼ੀਆਂ ਹੋਈਆਂ ਇਕੱਠ ਸਕੂਲੀ ਟ੍ਰੇਨਿੰਗ ਫਿਜੀਕਲ ਐਕਸਸਾਈਜ਼ ਤੌਰ 'ਤੇ ਵੀ ਇਹਨੂੰ ਕੀਤਾ ਜਾਂਦਾ ਭੰਗੜਾ ਕੀਤਾ ਜਾਂਦਾ ਇਹ ਜੰਗ ਬੰਦਾ ਹੀ ਕਰ ਸਕਦਾ ਜਾਂ ਇਹ ਸਮਝੋ ਕਿ ਜਿਹੜਾ ਬੰਦਾ ਭੰਗੜਾ ਪਾਉਂਦਾ ਉਹ ਜੰਗ ਹੋਵੇਗਾ ਹੀ ਹੋਵੇਗਾ

ਕੁਛ ਬੰਦੇ ਇਹਨੂੰ ਇਹਦੀ ਕੁਛ ਗਲਤ ਈ ਕਸਮ ਇਹਦੇ ਕਿ ਭੰਗੜਾ ਸਿਰਫ਼ ਜੰਗ ਲੜਕੇ ਹੀ ਕਰ ਸਕਦੇ ਹਾਂ ਇਹ ਲੋਕਾਂ ਦੀਆਂ ਧਾਰਨਾਵਾਂ ਉਹ ਧਾਰਨਾਵਾਂ ਜ਼ਿਆਦਾ ਸਹੀ ਨਹੀਂ ਹੈਗੀਆਂ ਕਿਉਂਕਿ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਕਲਚਰ ਦੇ ਬਾਰੇ ਮੈਂ ਇਹ ਹੀ ਕਹਿ ਸਕਦਾ ਕਿ ਇੱਕ ਗਾਣਾ ਵੀ ਆਉਂਦਾ ਵਿਆਹਾਂ 'ਚ ਵਿਆਹ ਦੇ ਐਂਡ 'ਚ ਤਕਰੀਬਨ ਆਉਂਦਾ ਗਾਣਾ ਉਹ ਹਮੇਸ਼ਾ ਹੀ ਕਿ ਬਹਿ ਕੇ ਦੇਖ ਜਵਾਨਾ ਪਾਵੇ ਭੰਗੜਾ ਪਾਉਂਦੇ ਨੇ ਕਾਹਦੇ ਪਾਉਂਦੇ ਆ ਉਹ ਖੁਰਾਕਾਂ ਵਧੀਆ ਖਾਂਦੇ ਆ ਕਿਸੇ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਕਈ ਹਜੇ ਵੀ ਖਾਂਦੇ ਆ ਭੰਗੜਾ ਤਾਂ ਤੁਹਾਡਾ ਮਾਨਸਿਕ ਵਿਕਾਸ ਵੀ ਕਰਦਾ ਭੰਗੜੇ ਨਾਲ ਤੁਹਾਡੇ ਯਾਰ ਦੋਸਤ ਸਾਰੇ ਹੀ ਖੁਸ਼ੀ ਮਨਾਉਂਦੇ ਆ ਭੰਗੜਾ ਤਾਂ ਇੱਕ ਬਹੁਤ ਵੱਡੀ ਜ਼ਿੰਦਗੀ ਦੀ ਇੱਕ ਐਕਸਰਸਾਈਜ਼ ਆ ਜਿਹੜਾ ਕਿ ਤੁਹਾਡੇ ਆਪਸੀ ਮੇਲ ਭਾਵ ਨੂੰ ਵਧਾਉਂਦਾ ਕੁਛ ਬੰਦੇ ਦੀ ਸੋਚ ਆਪਣੀ ਸੋਚ ਉਹਨਾਂ ਦੀ ਹੋ ਸਕਦੀ ਹੈ ਕਿ ਭੰਗੜੇ 'ਚ ਹਾਂ ਹੁੱਲੜਬਾਜ਼ੀ ਹੁੰਦੀ ਕਈ ਵਾਰੀ ਗਲਤ ਐਕਸ਼ਨ ਹੁੰਦਾ ਕਈ ਬੰਦੇ ਭੰਗੜਾ ਪਾਉਂਦੇ ਪਾਉਂਦੇ ਠੁੱਡਾ ਠਿੱਬੀ ਵੀ ਮਾਰਦੇ ਆ ਗਲਤ ਐਕਸ਼ਨ ਵੀ ਕਰਦੇ ਜਿਹਨਾਂ ਨੂੰ ਨਹੀਂ ਆਉਂਦਾ ਕੁਛ ਮੰਨੋਰੰਜਨ ਦਾ ਸਾਧਨ ਵੀ ਬਣਦੇ ਆ ਜਿਹਨਾਂ ਨੂੰ ਭੰਗੜਾ ਨਹੀਂ ਆਉਂਦਾ ਪਰ ਉਹਨਾਂ ਦਾ ਐਕਸ਼ਨ ਅਣਜਾਣਪੁਣੇ ਜਿਹੇ ਐਕਸ਼ਨ ਇਦਾਂ ਦੇ ਕੀਤੇ ਹੁੰਦੇ ਹੈ ਕਿ ਉਹ ਐਕਸ਼ਨ ਉਹਨਾਂ ਦੇ ਜਿਹੜੇ ਹੈ ਬਹੁਤ ਵਧੀਆ ਲੱਗਦੇ ਹੈ ਜਿੱਦਾਂ ਬਜ਼ੁਰਗ ਬੰਦੇ ਆ ਜਿਹੜੇ ਭੰਗੜਾ ਪਾਉਂਦੇ ਆ ਉਹ ਉਹਨਾਂ ਦੇ ਪੋਤੇ ਦੇਖਦੇ ਆ ਉਹਨਾਂ ਦੇ ਦੋਹਤੇ ਦੇਖਦੇ ਆ ਦੋਹਤੇ ਪੋਤੇ ਦੇਖਦੇ ਹੈ ਤਾਂ ਅਗਲੇ ਖੁਸ਼ ਹੁੰਦੇ ਦੇਖੋ ਸਾਡੇ ਬਾਬਾ ਜੀ ਸਾਡੇ ਨਾਨਾ ਜੀ ਕਿੰਨੇ ਫਿਟ ਹੈ ਕਿੰਨਾ ਵਧੀਆ ਭੰਗੜਾ ਪਾਉਂਦੇ ਆ ਸਾਡੇ ਸਾਹਮਣੇ ਤਾਂ ਕਦੇ ਪਾਇਆ ਨਹੀਂ ਬਾਬਾ ਜੀ ਵਿਆਹ 'ਚ ਪਾਉਂਦੇ ਬਾਬਾ ਜੀ ਨਾਨਾ ਜੀ ਵਿਆਹ 'ਚ ਭੰਗੜਾ ਪਾਉਂਦੇ ਤਾਂ ਕੁਛ ਬੰਦੇ ਇਹਨੂੰ ਬੁਰਾ ਮਨਾਉਂਦੇ ਹੈ ਕਿ ਦੇਖੋ ਬੁੱਢੇ ਹੋ ਕੇ ਭੰਗੜਾ ਪਾਉਂਦੇ ਇਹ ਕਿੱਦਾਂ ਨੱਚਦੇ ਆ ਹੈ ਨਾ ਇਹਨਾਂ ਨੂੰ ਆਪਣੀ ਉਮਰ ਦਾ ਲਿਹਾਜ਼ ਨਹੀਂ ਉਹ ਸੋਚ ਲੋਕਾਂ ਦੀ ਹੋਵੇਗੀ ਇਹ ਜਿਹੜੀ ਕਿ ਨਕਾਰਾਤਮਕ ਸੋਚ ਜਿਹੜੀ ਕਹਿੰਦੇ ਆ ਮੈਂ ਇੱਕ ਵਾਰ ਫਿਰ ਕਹਿੰਦਾ ਕਿ ਇਹ ਸ ਇਹ ਮੇਰੇ ਵਿਚਾਰ ਇਹਨੂੰ ਚੰਗਾ ਨਹੀਂ ਸਮਝਦੇ ਮੈਂ ਤਾਂ ਮੇਰੀ ਵਿਚਾਰ ਤਾਂ ਇਹ ਹੈਗੇ ਆ ਇਹ ਬੱਚਿਓ ਤੋਂ ਲਾ ਕੇ ਬੁੱਢੇ ਤੱਕ ਇਹ ਮੌਕਾ ਮਿਲੇ ਘਰ 'ਚ ਸੋਸਾਇਟੀ 'ਚ ਕਿਤੇ ਵੀ ਐਕਸਸਾਈਜ਼ ਦੇ ਤੌਰ 'ਤੇ ਭੰਗੜਾ ਪਾਉਣਾ ਚਾਹੀਦਾ ਇਹ ਹੱਸਣ ਦਾ ਬਹਾਨਾ ਮਿਲਦਾ ਹੱਸਣ ਦਾ ਮੌਕਾ ਮਿਲਦਾ ਤੁਹਾਡਾ ਮਾਨਸਿਕ ਤਣਾਅ ਦੂਰ ਹੁੰਦਾ ਮਾਨਸਿਕ ਤਣਾਅ ਦੂਰ ਹੁੰਦਾ ਜਿਹੜੇ ਅਲੱਗ ਤਰ੍ਹਾਂ ਉਹਨੂੰ ਯੂਜ ਕਰਦੇ ਹੈ ਉਹ ਅਲੱਗ ਗੱਲ ਆ ਕੁੱਲ ਮਿਲਾ ਕੇ ਭੰਗੜਾ ਠੀਕ ਹੈ ਨਕਾਰਾਮਕ ਜਿਹੜੇ ਸੋਚਦੇ ਹੈ ਉਹ ਜ਼ਿਆਦਾ ਵਧੀਆ ਨਹੀਂ ਹੈ